ਹਰੇਕ ਨੁਕ ਦੇ ਅੰਦਰ ਕਈ ਪ੍ਰਕਾਰ ਦੀਆਂ ਸ਼ਕਤੀਆਂ ਜਾਂ ਕਮਜ਼ੋਰੀਆਂ ਹੁੰਦੀਆਂ ਹਨ ਮੇਰੇ ਅੰਦਰ ਵੀ ਬਹੁਤ ਕਮਜ਼ੋਰੀਆਂ ਅਤੇ ਨਾਲ ਨਾਲ ਬਹੁਤ ਸ਼ਕਤੀਆਂ ਵੀ ਹਨ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਅਤੇ ਮੇਰੀ ਸਭ ਤੋਂ ਵੱਡੀ ਸ਼ਕਤੀ ਮੇਰਾ ਪਰਿਵਾਰ ਹੈ ਇਸ ਤੋਂ ਇਲਾਵਾ ਮੇਰਾ ਆਤਮ ਵਿਸ਼ਵਾਸ ਮੇਰੀ ਸਭ ਤੋਂ ਵੱਡੀ ਸ਼ਕਤੀ ਹੈ ਜਿਸ ਦੇ ਬਲਬੂਤੇ ਮੈਂ ਬਹੁਤ ਜ਼ਿੰਮੇਵਾਰੀ ਨਾਲ ਹਰ ਕੰਮ ਬਹੁਤ ਸ਼ਿੱਦਤ ਨਾਲ ਪੂਰਾ ਕਰਦੀ ਹਾਂ ਮੇਰੀ ਅੱਗੇ ਵਧਣ ਦੀ ਚਾਹ ਵਿੱਚ ਮੇਰੀਆਂ ਕਈ ਕਮਜ਼ੋਰੀਆਂ ਜਿਵੇਂ ਸਾਡੀ ਮਾਲੀ ਹਾਲਤ ਮੇਰੀ ਸਿਹਤ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਰੁਕਾਵਟ ਪਾਉਂਦੇ ਹਨ ਪਰ ਮੇਰਾ ਆਤਮ ਵਿਸ਼ਵਾਸ ਅਤੇ ਮੇਰੀ ਪੋਜੀਟਿਵ ਸੋਚ ਮੈਨੂੰ ਅੱਗੇ ਵਧਣ ਲਈ ਸ਼ਕਤੀ ਪ੍ਰਦਾਨ ਕਰਦੀ ਹੈ ਜਿਸ ਨਾਲ ਮੈਂ ਹਰ ਰੋਜ਼ ਮਜ਼ਬੂਤ ਹੁੰਦੀ ਜਾਂਦੀ ਹਾਂ